ਪੰਜ ਜਨਵਰੀ ਉੱਨੀ ਸੌ ਸੱਠ ਛੇ ਜਨਵਰੀ ਉੱਨੀ ਸੌ ਇਕਾਹਠ ਸੱਤ ਮਾਰਚ ਉੱਨੀ ਸੌ ਪੈਂਹਠ ਅੱਠ ਅਪ੍ਰੈਲ ਉੱਨੀ ਸੌ ਸੱਤਰ ਇੱਕੀ ਨਵੰਬਰ ਵੀਹ ਸੌ ਤੇਈ